ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਤੁਸੀਂ ਆਪਣਾ

ਪੰਜਾਬ ਦੇ ਰਹਿਣ ਵਾਲੇ ਹੋ ਹਾਂਜੀ ਭਾਅ ਜੀ ਮੈਂ ਨਾ ਬਾਹਰੋਂ ਆਇਆ ਸੀਗਾ ਅੰਬਾਲਾ ਆਪਣਾ ਅੰਬਾਲੇ ਤੋਂ ਅਤੇ ਮੈਂ ਨਾ ਆਪਣੀ ਗਡੀ ਗੱਡੀ ਨਾਲ ਲੈ ਕੇ ਆਉਣਾ ਅਤੇ ਮੈਂ ਪੰਜਾਬ ਵਿੱਚ ਸ਼ਿਫਟ ਹੋਣਾ ਚਾਹੁੰਦਾ ਅੰਮ੍ਰਿਤਸਰ ਸਿਟੀ 'ਚ ਅਤੇ ਭਾਅ ਜੀ ਮੈਂ ਨਾ ਇੱਥੋਂ ਦਾ ਆਪਣਾ ਨੰਬਰ ਰਜਿਸਟਰ ਕਰਾਉਣਾ ਚਾਹੁੰਦਾ ਗੱਡੀ ਦਾ ਮਤਲਬ ਇੱਥੋਂ ਦਾ ਨੰਬਰ ਲੈਣਾ ਚਾਹੁੰਦਾ ਉਹਦਾ ਕ੍ਰੈਟਰੀਆ ਦੱਸ ਦਿਓ ਭਾਅ ਜੀ ਮੇਰੇ ਕੋਲ ਵੀਜਾ ਹੋਂਡਾ ਸੀਟੀ ਦੀ ਹਾਂਜੀ ਅੱਛਾ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਠੀਕ ਹੈ ਭਾਅ ਜੀ ਤੁਹਾਡੀ ਤਾਂ ਨਹੀਂ ਕੋਈ ਫੀਸ ਹੈਗੀ ਇਹਦੇ ਵਿੱਚ ਠੀਕ ਹੈ ਜੀ ਠੀਕ ਠੀਕ ਹੈ ਭਾਅ ਜੀ ਤੁਸੀਂ ਨਾ ਉਹਨਾਂ ਨੂੰ ਮੇਰਾ ਨੰਬਰ ਦੇ ਦੇਣਾ ਮੈਂ ਉਹਨਾਂ ਦਾ ਕੰਟੈਕਟ ਕਰ ਲਾਂਗਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ